ਜਿਵੇਂ ਕਿ ਮੈਂ ਆਪਣੀ ਇੱਕ ਜੌਬ ਕਰਦੀ ਹਾਂ ਨਰਸਿੰਗ ਪ੍ਰੋਫੈਸ਼ਨ ਦੇ ਵਿੱਚ ਮੈਂ ਆਪਣੀ ਸਟੱਡੀ ਕੰਪਲੀਟ ਕੀਤੀ ਹੈ ਅਤੇ ਮੈਨੂੰ ਲੱਗਦਾ ਕਿ ਉਹ ਸਟੱਡੀ ਕੰਪਲੀਟ ਕਰਨ ਦਾ ਮੈਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਇਆ ਹੈ ਕਿਉਂਕਿ ਮੈਂ ਉਸ ਸਟੱਡੀ ਦੇ ਥਰੂ ਹੀ ਆਪਣੇ ਮਾਂ ਬਾਪ ਦੀ ਸੇਵਾ ਕਰ ਪਾ ਰਹੀ ਹਾਂ ਆਪਣੇ ਜਿੰਨੇ ਵੀ ਸਾਡੇ ਪੇਸ਼ੈਂਟਸ ਆ ਰਹੇ ਆ ਉਹ ਬੜੇ ਵਧੀਆ ਤੰਦਰੁਸਤ ਹੋ ਕੇ ਜਦੋਂ ਵਾਪਸ ਮੁੜਦੇ ਆ ਤਾਂ ਉਸ ਚੀਜ਼ ਲਈ ਬੜੀ ਖੁਸ਼ੀ ਹੁੰਦੀ ਆ ਅਤੇ ਮੈਨੂੰ ਜਿਹੜਾ ਇਹ ਮਾਰਗ ਮੇਰੇ ਜਿਹੜਾ ਦਿਖਾਇਆ ਸੀਗਾ ਮੇਰੇ ਪਿਤਾ ਸ਼੍ਰੀ ਮੇਰੇ ਉਹਨਾਂ ਨੇ ਹੀ ਮੈਨੂੰ ਦੱਸਿਆ ਸੀਗਾ ਕਿ ਜਦੋਂ ਵੀ ਜਦ ਲੋਕ ਨਾ ਬਹੁਤ ਦੁਖੀ ਆਉਂਦੇ ਆ ਹੌਸਪੀਟਲ ਦੇ ਵਿੱਚ ਅਤੇ ਉਹਨਾਂ ਨੇ ਵੀ ਬਹੁਤ ਦੇਖਿਆ ਕਿ ਹਾਂਜੀ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਅਤੇ ਇੱਕ ਸਹੀ ਤਰੀਕੇ ਦਾ ਇਲਾਜ ਨਹੀਂ ਮਿਲ ਪਾਉਂਦਾ ਹੈ ਅਤੇ ਮੈਂ ਵੀ ਉਸ ਅੱਕਾਰਡਿੰਗ ਹੀ ਜਿੱਦਾਂ ਉਹਨਾਂ ਨੇ ਮੈਨੂੰ ਦੱਸਿਆ ਮੈਂ ਉਹਨਾਂ ਦੇ ਹੀ ਮਾਰਗ ਦਰਸ਼ਨ 'ਤੇ ਚੱਲ ਕੇ ਆਪਣਾ ਇਹ ਪ੍ਰੋਫੈਸ਼ਨ ਚੂਜ਼ ਕੀਤਾ ਸੀਗਾ ਔਰ ਮੈਨੂੰ ਲਗਦਾ ਇਹ ਪ੍ਰੋਫੈਸ਼ਨ ਚੂਜ਼ ਕਰਕੇ ਮੈਂ ਕੋਈ ਵੀ ਗਲਤੀ ਨਹੀਂ ਕੀਤੀ ਕਿਉਂਕਿ ਇਸ ਪ੍ਰੋਫੈਸ਼ਨ ਦੇ ਥਰੂ ਹੀ ਮੈਂ ਬਹੁਤ ਲੋਕਾਂ ਨੂੰ ਜਾਣ ਪਾਈ ਆ ਔਰ ਬਹੁਤ ਸਾਰੀਆਂ ਚੀਜ਼ਾਂ ਸਿੱਖ ਪਾਈ ਹੈ ਅਤੇ ਮੈਨੂੰ ਲੱਗਦਾ ਕਿ ਮੈਂ ਅੱਗੇ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਸਿੱਖਾਂਗੀ ਜੋ ਕਿ ਮੈਨੂੰ ਮੇਰੇ ਅੱਗੇ ਦੀ ਲਾਈਫ ਲਈ ਅੱਗੇ ਦੇ ਕਰੀਅਰ ਲਈ ਬੇਟਰ ਹੋਏਗਾ